ਅਤੇ ਇਹ ਦੁਕਾਨਾਂ ਵਾਲੇ ਅਤੇ ਉਹਨਾਂ ਨੂੰ ਤਾਂ ਕੁਛ ਵੀ ਕੋਈ ਇਨਕਮ ਹੀ ਨਹੀਂ ਰਹੀ ਸੀਗੀ ਅਤੇ ਕਰੋਨਾ ਟਾਈਮ ਤਾਂ ਬਹੁਤ ਜ਼ਿਆਦਾ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਲੋਕਾਂ ਨੂੰ ਜਿਹਨਾਂ ਦੇ ਕੰਮਕਾਰ ਸੀਗੇ ਉਹ ਵੀ ਠੱਪ ਹੋ ਗਏ ਅਤੇ ਜਿਹਨਾਂ ਦਾ ਕੋਈ ਹੋਰ ਜਿਹੜੇ ਕੋਈ ਨੌਕਰੀਆਂ ਵਾਲੇ ਸੀਗੇ ਉਹ ਜਿਹੜੇ ਤਾਂ ਸਰਕਾਰੀ ਜੋਬਾਂ ਵਿੱਚ ਸੀਗੇ ਉਹਨਾਂ ਨੂੰ ਤਾਂ ਚਲੋ ਸੈਲਰੀਆਂ ਆਉਂਦੀਆਂ ਰਹੀਆਂ ਪਰ ਜਿਹੜੇ ਪ੍ਰਾਈਵੇਟ ਜੋਬ ਵਾਲੇ ਸੀਗੇ ਉਹ ਕਾਫ਼ੀ ਲੋਕ ਐਵੇਂ ਹੋਏ ਕਿ ਉਹਨਾਂ ਨੂੰ ਕਾਫ਼ੀ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਅਤੇ ਜਿਵੇਂ ਕਿ ਮੇਰੇ ਖੇਤਰ ਹੁਸ਼ਿਆਰਪੁਰ ਵਿੱਚ ਕਾਫ਼ੀ ਕਾਰੋਬਾਰ ਬੰਦ ਹੋ ਗਏ ਸੀਗੇ ਇੱਥੇ ਜ਼ਿਆਦਾਤਰ ਜਿਵੇਂ ਦੁੱਧ ਦੀਆਂ ਡਾਇਰੀਆਂ ਨੇ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਦਾ ਦੁੱਧ ਨਹੀਂ ਚੁੱਕ ਹੋਇਆ ਅਤੇ ਕਾਫ਼ੀ ਜ਼ਿਆਦਾ ਹੀ ਮੁਸ਼ਕਿਲਾਂ ਉਹਨਾਂ ਨੇ ਸਾਹਮਣਾ ਕੀਤੀਆਂ ਅਤੇ ਅਸੀਂ ਸਾਰਿਆਂ ਨੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ